ਵਾਤਾਵਰਨ ਇੱਕ ਅਜਿਹੀ ਚੀਜ਼ ਹੈ ਜਿਸਦੇ ਨਾਲ ਸਾਡੀ ਸਿਹਤ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਇਸਦੇ ਕੁਛ ਚੰਗੇ ਪ੍ਰਭਾਵ ਵੀ ਆ ਕੁਛ ਬੁਰੇ ਪ੍ਰਭਾਵ ਵੀ ਆ ਚੰਗੇ ਪ੍ਰਭਾਵ ਇਹ ਹੈ ਕਿ ਇਹ ਇਕ ਪ੍ਰਕਿਰਤੀ ਹੈ ਇਸ ਤੋਂ ਸਾਨੂੰ ਬਹੁਤ ਸਾਰੀਆਂ ਬਹੁਤ ਸਾਰੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਬਹੁਤ ਸਾਰਾ ਲੱਕੜੀ ਦਾ ਸਮਾਨ ਪ੍ਰਾਪਤ ਹੁੰਦਾ ਹੈ ਇਹਨਾਂ ਦੇ ਸਾਨੂੰ ਬਹੁਤ ਸਾਰੇ ਫਾਇਦੇ ਹਨ ਪਰ ਇਹਦੇ ਨਾਲ ਹੀ ਅਤੇ ਕੁਝ ਬਹੁਤ ਸਾਰੇ ਨੁਕਸਾਨ ਵੀ ਹੈ ਜਿਨ੍ਹਾਂ ਦੇ ਕਰਕੇ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਸ਼ੌਰ ਪ੍ਰਦੂਸ਼ਣ ਹੋ ਗਿਆ ਹਵਾ ਦਾ ਪ੍ਰਦੂਸ਼ਣ ਹੋ ਗਿਆ ਪਾਣੀ ਦਾ ਪਦੂਸ਼ਣ ਹੋ ਗਿਆ ਭੂਮੀ ਦਾ ਪ੍ਰਦੂਸ਼ਣ ਹੋ ਗਿਆ ਇਹ ਯੇ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਇਹਨਾਂ ਦੇ ਨਾਲ ਪ੍ਰੋਬਲਮਜ਼ ਆਉਂਦੀਆਂ ਜਿਵੇਂ ਪਾਣ ਹਵਾ ਦਾ ਪ੍ਰਦੂਸ਼ਣ ਜਿੱਦਾਂ ਹਵਾ ਦੇ ਵਿੱਚ ਜਿਹੜੀ ਸਾਡੀ ਸਾਨੂੰ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਹੈ ਸਾਹ ਲੈਣ ਦੀ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਹਵਾ ਦੇ ਵਿੱਚ ਮੈ ਮੈਂ ਰਲ ਕੇ ਫੈਲਦੀਆਂ ਆਪਸ ਜਿਸ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਜ਼ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਭੂਮੀ ਪ੍ਰਦੂਸ਼ਣ ਇੱਦਾਂ ਹੈ ਕਿ ਜਿਹੜੀਆਂ ਫੈਕਟਰੀਆਂ ਹੈ ਫੈਕਟਰੀਆਂ ਤੋਂ ਧੂੰਆਂ ਆਉਂਦਾ ਹੈ ਸੌਰੀ ਫੈਕਟਰੀਆਂ ਦਾ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਗੰਧਲਾ ਹੈ ਤੇਜ਼ਾਬੀ ਹੈ ਅਤੇ ਜਿਸ ਦੇ ਕਾਰਨ ਉਹ ਪਾਣੀ ਦੇ ਵਿੱਚ ਮਿਕਸ ਹੋ ਕੇ ਗ ਸਾਡੇ ਅੰਦਰ ਜਾਂਦਾ ਹੈ ਅਤੇ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਹ ਵ ਸ਼ੌਰ ਪ੍ਰਦੂਸ਼ਣ ਹੈ ਸ਼ੌਰ ਪ੍ਰਦੂਸ਼ਣ ਉਹ ਹੈ ਜਿਸ ਦੇ ਨਾਲ ਜਿਹੜੀ ਟਰਾਫਿਕ ਆ ਟਰਾਫਿਕ ਦੇ ਵਿੱਚ ਵਾਹਨ ਹੈ ਵਾਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਧੂੰਆਂ ਹੈ ਉਹ ਉਹ ਵੀ ਜਾ ਕੇ ਹਵਾ ਦੇ ਵਿੱਚ ਹੁੰਦਾ ਹੈ ਇ ਹੋਰ ਨੌਆਇਸ ਅਵਾਜ਼ਾਂ ਜਿਹੜੀਆਂ ਡੀ ਜੇ ਵਿਆਹਾਂ 'ਚ ਬਹੁਤ ਜਿਸਦੇ ਨਾਲ ਬਹੁਤ ਸਾਰੀਆਂ ਸਮਸਿਆਵਾਂ ਹੁੰਦੀਆਂ ਹਨ ਇਸ ਦੇ ਲਈ ਸ ਸਾਨੂੰ ਵੀ ਬਹੁਤ ਸਾਰੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਸਰਕਾਰ ਨੂੰ ਵੀ ਇਸ ਦਾ ਕੋਈ ਨਾ ਕੋਈ ਜਿਹੜਾ ਹੱਲ ਹੈ ਉਹ ਕਰਨਾ ਚਾਹੀਦਾ ਹੈ ਤਾਂ ਜੋ ਜਿਹੜਾ ਵਾਤਾਵਰਨ ਸਬਮ ਸਬੰਧੀ ਸਮੱਸਿਆਵਾਂ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਅਤੇ ਜਿਹੜਾ ਸਾਡਾ ਵਾਤਾਵਰਨ ਹੈ ਉਹਨੂੰ ਸ਼ੁੱਧ ਕੀਤਾ ਜਾ ਸਕੇ